ਮੈਂ ਮੀਸ਼ੋ ਐਪ ਤੋਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਹਨ ਜਿਹਦਾ ਰਿਜ਼ਲਟ ਬਹੁਤ ਹੀ ਵਧੀਆ ਰਿਹਾ ਉਹ ਮੀਸ਼ੋ ਦੇ ਉੱਤੇ ਜਿਹੜਾ ਵੀ ਸਮਾਨ ਮਿਲਦਾ ਉਹ ਬਹੁਤ ਹੀ ਘੱਟ ਰੇਟਾਂ 'ਤੇ ਅਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਮਿਲਦਾ ਹੈ ਉੱਥੋਂ ਮੈਂ ਬੱਚੇ ਦੇ ਐਜੂਕੇਸ਼ਨ ਦੇ ਇਕਿਪਮੈਂਟ ਮੰਗਵਾਏ ਸੀਗੇ ਜੋ ਕਿ ਬਹੁਤ ਹੀ ਵਧੀਆ ਨਿਕਲੇ ਅਤੇ ਉਸ ਦੇ ਮੈਨੂੰ ਬਹੁਤ ਜ਼ਿਆਦਾ ਫਾਇਦੇ ਵੀ ਰਿਜਲਟ ਵੀ ਚੰਗੇ ਮਿਲੇ ਅਸੀਂ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੀਸ਼ੋ ਦੇ ਐਪ ਤੋਂ ਹੀ ਖਰੀਦਦੇ ਹਾਂ ਕਿਉਂਕਿ ਇਹਦਾ ਰਿਜ਼ਲਟ ਬਹੁਤ ਵਧੀਆ ਰਹਿੰਦਾ ਅਤੇ ਬੱਚੇ ਦੇ ਕਾ ਬੱਚੇ ਦੇ ਕੰਮ ਦੀਆਂ ਚੀਜ਼ਾਂ ਉੱਥੇ ਬਹੁਤ ਵਧੀਆ ਤਰੀਕੇ ਵਧੀਆ ਮਿਲਦੀਆਂ ਨੇ ਅਤੇ ਉੱਥੇ ਜਿਹੜੀਆਂ ਅਲੱਗ ਅਲੱਗ ਟਾਈਪਸ ਵੀ ਉਹਦੀਆਂ ਮਿਲ ਜਾਂਦੀਆਂ ਨੇ ਜਿਵੇਂ ਕਿ ਬੱਚੇ ਦੇ ਖਿਡੌਣੇ ਹੋ ਗਏ ਬੱਚੇ ਦੇ ਐਜੂਕੇਸ਼ਨ ਤੋਂ ਰਿਲੇਟਡ ਟੋਇਜ਼ ਹੋ ਗਏ ਇੱਦਾਂ ਦਾ ਬਹੁਤ ਵਧੀਆ ਸਮਾਨ ਮਿਲਦਾ ਹੈ ਅਤੇ ਉੱਥੇ ਰੇਟ ਜਿਹੜੇ ਨੇ ਬਹੁਤ ਘੱਟ ਨੇ ਅਤੇ ਉਹਦੀ ਰਿਟਰਨ ਜਿਹੜੀ ਪੋਲਸੀ ਹੈ ਉਹ ਸਭ ਤੋਂ ਵਧੀਆ ਹੈ ਜੇ ਜੇ ਕਿਤੇ ਉੱਥੇ ਰਿਟਰਨ ਕਰਦੇ ਹਾਂ ਸਮਾਨ ਅਤੇ ਨਾਲ ਦੀ ਨਾਲ ਜਿਹੜੇ ਪੈਸੇ ਆ ਉਹ ਆਪਣੇ ਅਕਾਊਂਟ ਦੇ ਵਿੱਚ ਨਾਲ ਦੀ ਨਾਲ ਕ੍ਰੈਡਿਟ ਹੋ ਜਾਂਦੇ ਨੇ ਉੱਥੇ ਜਮਾਂ ਵੀ ਟਾਈਮ ਨਹੀਂ ਲੱਗਦਾ ਅਤੇ ਨਾਲੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਸੁਚੱਜੇ ਤਰੀਕੇ ਨਾਲ ਐਪ ਨੂੰ ਵਧੀਆ ਕੀਤਾ ਹੋਇਆ